ਇੱਕ ਵਾਰ ਮੇਰੀ ਕਾਨਫਰੰਸ ਮੀਟਿੰਗ ਸੀ ਜਿਸ ਵਿੱਚ ਇੱਕ ਟੋਪਿਕ 'ਤੇ ਮੈਂ ਦੋ ਘੰਟੇ ਬੋਲਣਾ ਸੀ ਤਾਂ ਉਦੋਂ ਮੇਰਾ ਫਰਸਟ ਟਾਈਮ ਸੀ ਕਿ ਦੋ ਘੰਟੇ ਇੱਕ ਮੀਟਿੰਗ 'ਚ ਬੋਲਣਾ ਕਾਨਫਰੰਸ 'ਚ ਤਾਂ ਮੈਨੂੰ ਬਹੁਤ ਜ਼ਿਆਦਾ ਹੀ ਫੀਲ ਹੋ ਰਿਹਾ ਸੀ ਥੋੜ੍ਹੀ ਜਿਹੀ ਸ਼ਰਮ ਆ ਰਹੀ ਸੀ ਤਾਂ ਜਿਸ ਕਰਕੇ ਮੈਂ ਬਹੁਤ ਡਰ ਰਿਹਾ ਸੀ ਨਰਵਸ ਹੋ ਰਿਹਾ ਸੀ ਤਾਂ ਫਿਰ ਮੈਨੂੰ ਮੇਰੇ ਫਰੈਂਡਸ ਨੇ ਹੌਂਸਲਾ ਦਿੱਤਾ ਵੀ ਕਿ ਤੂੰ ਕਰ ਸਕਦਾ ਸਭ ਕੁਛ ਵੀ ਕੋਈ ਜ਼ਿਆਦਾ ਔਖਾ ਨਹੀਂ ਤੇਰੇ ਲਈ ਤਾਂ ਮੈਂ ਉਦੋਂ ਉਹਨਾਂ ਦੇ ਕਹਿਣ 'ਤੇ ਉਹ ਮੀਟਿੰਗ ਅਟੈਂਡ ਕੀਤੀ ਦੋ ਘੰਟੇ ਬੋਲ ਰਿਹਾ ਸੀ ਤਾਂ ਉਹ ਦੋ ਘੰਟੇ ਦਾ ਸਮਾਂ ਬਹੁਤ ਹੀ ਵਧੀਆ ਨਿਕਲਿਆ ਅਤੇ ਮੈਨੂੰ ਪਤਾ ਆਪਣੇ ਆਪ ਨੂੰ ਵੀ ਪਤਾ ਨਹੀਂ ਲੱਗਿਆ ਕਦੋਂ ਦੋ ਘੰਟੇ ਹੋ ਗਏ ਔਰ ਕਦੋਂ ਫ੍ਰੇ ਕਾਨਫਰੰਸ ਪੂਰੀ ਹੋ ਗਈ ਇਵੇਂ ਹੀ ਬਹੁਤ ਜ਼ਿਆਦਾ ਵਧੀਆ ਟਾਈਮ ਨਿਕਲਿਆ ਤਾਂ ਬਲਕਿ ਮੇਰੇ ਕੋਲ ਹੋਰ ਜ਼ਿਆਦਾ ਹਲੇ ਵਰਡ ਪਏ ਸੀ ਬੋਲਣ ਲਈ ਫਿਰ ਵੀ ਟਾਈਮ ਪੂਰਾ ਹੋ ਗਿਆ ਦੋ ਘੰਟੇ ਦੀ ਕਾਨਫਰੰਸ ਸੀ ਤਾਂ ਬਹੁਤ ਜ਼ਿਆਦਾ ਵਧੀਆ ਹੋਇਆ ਤਾਂ ਅਗਰ ਜੇ ਮੇਰੇ ਵੀ ਫਰੈਂਡਸ ਮੈਨੂੰ ਨਾ ਉਸ ਲਈ ਪ੍ਰੇਰਿਤ ਕਰਦੇ ਨਾ ਮੈਨੂੰ ਹੌਂਸਲਾ ਦਿੰਦੇ ਤਾਂ ਮੇਰੇ ਤੋਂ ਹੁਣ ਨਹੀਂ ਹੋਣੀ ਸੀ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਉਸ ਕਾਨਫਰੰਸ 'ਚ